ਹਾਂਜੀ ਮੈਂ ਪੁੱਛਦੀ ਸੀ ਤੁਸੀਂ ਗੁ ਗੁਰਦਆਰਾ ਸਾਹਿਬ ਤੋਂ ਬੋਲਦੇ ਹੋ ਕਮੇਟੀ ਮੈਂਬਰ ਦੇ ਮੈਂ ਨਾ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੈਂ ਪੁੱਛਦੀ ਸੀ ਕਿ ਮੈਂ ਕਿਹਾ ਅਸੀਂ ਨਾ ਮੇਰੇ ਬੱਚੇ ਦਾ ਉੱਥੇ ਟਕਸਾਲ ਸਕੂਲ 'ਚ ਅਡਮੀਸ਼ਨ ਕਰਾਉਣਾ ਸੀਗਾ ਉਹਦੇ ਬਾਰੇ ਜਾਣਕਾਰੀ ਲੈਣੀ ਸੀ ਵੀ ਆਪਾਂ ਨੂੰ ਕੀ ਕੁਛ ਲੱਗਦਾ

ਹਾਂਜੀ ਹਾਂਜੀ ਇੱਕ ਨੀਲੇ ਰੰਗ ਦਾ ਅਤੇ ਅਤੇ ਆਉਣ ਵਾਸਤੇ ਕੋਈ ਆਈ ਡੀ ਪਰੂਫ ਵਗੈਰਾ ਜੀ ਬੱਚਾ ਹੈਗਾ ਜੀ ਦਸ ਗਿਆਰਾਂ ਸਾਲਾਂ ਦਾ ਹਾਂਜੀ ਨਹੀਂ ਪਹਿਲਾਂ ਇੱਥੇ ਨਹੀਂ ਮਤਲਬ ਪਲੇ ਸਟੋਰ ਵਗੈਰਾ ਨਹੀਂ ਬਣੇ ਹੁੰਦੇ ਗੇ ਪਲੇ ਸਕੂਲ ਬਣੇ ਹੁੰਦੇ ਉੱਥੇ ਲੱਗਿਆ ਸੀ ਬੱਚਾ ਹੁਣ ਪਹਿਲੀ ਵਾਰੀ ਪਾ ਰਹੇ ਹਾਂ ਅਡਮੀਸ਼ਨ ਤਾਂ ਪਹਿਲੀ ਵਾਰੀ ਹੋ ਰਿਹਾ ਡੈ ਗਿਆਰਾਂ ਸਾਲਾਂ ਦਾ ਠੀਕ ਹੈ ਜੀ ਅਤੇ ਆ ਕਦੋਂ ਸਕਦੇ ਹਾਂ ਅਸੀਂ ਗੱਲ ਕਰਨ ਵਾਸਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਓਰੀਜਨਲ ਹੈਗੇ ਐ ਠੀਕ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਨਾਲ ਹੀ ਆਵਾਂਗੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ